ਟੈਕਨੋਲੋਜੀ ਵਿੱਚ ਤਰੱਕੀ ਦੇ ਨਾਲ ਮੇਰੀ ਜ਼ਿੰਦਗੀ 'ਚ ਬਹੁਤ ਕੁਝ ਬਦਲਿਆ ਹੈ ਹੁਣ ਘਰ ਦੇ ਨੱਬੇ ਪ੍ਰਤੀਸ਼ਤ ਕੰਮ ਮੈਂ ਮੋਬਾਇਲ ਦੀ ਵਰਤੋਂ ਕਰਕੇ ਕਰਦੀ ਹਾਂ ਮੈਂ ਗਰੋਸਰੀ ਦਾ ਸਾਰਾ ਸਮਾਨ ਜਿਵੇਂ ਕਿ ਕੱਪੜੇ ਧੋਣ ਵਾਲੇ ਸਾਬਣ ਨਹਾਉਣ ਵਾਲੀ ਸਾਬਣ ਸਿਰ 'ਤੇ ਲਗਾਉਣ ਵਾਲਾ ਤੇਲ ਅਤੇ ਸ਼ੈਂਪੂ ਇਹ ਮੈਂ ਸਾਰਾ ਕੁਝ ਓਨਲਾਈਨ ਹੀ ਖਰੀਦਦੀ ਹਾਂ ਅਸੀਂ ਕਿਸੇ ਵੀ ਦੁਕਾਨ 'ਤੇ ਜਾਂਦੇ ਹਾਂ ਅਤੇ ਕੁਝ ਖਰੀਦਦੇ ਹਾਂ ਤਾਂ ਉਸ ਦੀ ਸਾਰੀ ਪੇਮੈਂਟ ਅਸੀਂ ਮੋਬਾਈਲ ਨਾਲ ਹੀ ਕਰਦੇ ਹਾਂ ਮੇਰੇ ਪਤੀ ਜਦੋਂ ਵੀ ਬਾਹਰ ਜਾਂਦੇ ਹਨ ਉਹ ਰੇਲ ਗੱਡੀ ਦੀ ਟਿਕਟ ਮੋਬਾਇਲ ਦੀ ਵਰਤੋਂ ਨਾਲ ਹੀ ਬੁੱਕ ਕਰਦੇ ਹਨ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਅਤੇ ਮੈਂ ਜਦੋਂ ਪੂਜਾ ਕਰਦੀ ਹਾਂ ਤਾਂ ਅੱਜ ਦੇ ਸਮੇਂ ਵਿੱਚ ਸਾਨੂੰ ਪਾਠ ਪੂਜਾ ਕਰਨੀ ਫੋਨ ਦੇ ਵਿੱਚ ਆਸਾਨ ਹੋ ਗਈ ਹੈ ਕਿਉਂਕਿ ਓਹਦੇ ਵਿੱਚ ਐਪ ਉਪਲਬਧ ਹਨ ਜਿਸ ਤਰ੍ਹਾਂ ਕਿ ਆਰਤੀ ਸੰਗ੍ਰਹਿ ਹਨੂੰਮਾਨ ਚਾਲੀਸਾ ਇਸ ਤਰ੍ਹਾਂ ਦੇ ਧਾਰਮਿਕ ਐਪ ਵੀ ਉਸ ਫੋਨ ਵਿੱਚ ਉਪਲਬਧ ਹਨ ਮੈਂ ਸਾਰੇ ਟੀ ਵੀ ਦੇ ਪ੍ਰੋਗਰਾਮ ਫਿਲਮਾਂ ਅਤੇ ਫਿਲਮਾਂ ਦੇ ਗਾਣੇ ਸਭ ਕੁਝ ਓਨਲਾਈਨ ਇੰਟਰਨੈੱਟ ਦੀ ਵਰਤੋਂ ਨਾਲ ਵੇਖਦੀ ਹਾਂ ਮੈਂ ਕੋਈ ਵੀ ਪ੍ਰੋਗਰਾਮ ਸਮੇਂ ਅਨੁਸਾਰ ਨਹੀਂ ਦੇਖਦੀ ਮੈਂ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਸਮਰੱਥਾ ਦੇ ਅਨੁਸਾਰ ਉਹ ਪ੍ਰੋਗਰਾਮ ਦੇਖ ਸਕਦੀ ਹਾਂ ਇੰਟਰਨੈੱਟ ਦੀ ਵਰਤੋਂ ਦੇ ਨਾਲ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਪੈਸੇ ਵੀ ਇੰਟਰਨੈੱਟ ਦੀ ਵਰਤੋਂ ਨਾਲ ਉਨ੍ਹਾਂ ਦੇ ਅਕਾਊਂਟ ਵਿੱਚ ਭੇਜਦੀ ਹਾਂ ਅਤੇ ਮੇਰੇ ਮਾਂ ਬਾਪ ਮੇਰਾ ਭਰਾ ਵੀ ਮੇ ਪੈਸੇ ਇੰਟਰਨੈੱਟ ਦੀ ਵਰਤੋਂ ਨਾਲ ਮੇਰੇ ਅਕਾਊਂਟ ਵਿੱਚ ਭੇਜਦੇ ਹਨ ਭਾਵ ਕਿ ਹੁਣ ਸਾਨੂੂੰ ਬੈਂਕ ਵਿੱਚ ਵੀ ਜਾਣ ਦੀ ਲੋੜ ਨਹੀਂ ਹੈ ਇੰਟਰਨੈੱਟ ਦੀ ਵਰਤੋਂ ਨਾਲ ਅਸੀਂ ਬੈਂਕ 'ਚ ਹੋ ਕੋਈ ਆਦਾਨ ਪ੍ਰਦਾਨ ਦੀ ਜਾਣਕਾਰੀ ਵੀ ਲੈਂਦੇ ਰਹਿੰਦੇ ਹਾਂ ਮੇਰੇ ਬੱਚੇ ਜਦੋਂ ਵੀ ਕਿਸੇ ਸਬਜੈਕਟ 'ਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਇੰਟਰਨੈੱਟ ਦੀ ਵਰਤੋਂ ਨਾਲ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ